ਜੀ ਹਾਂ ਮੈਂ ਆਪਣੀਆਂ ਫੋਟੋਆਂ ਤਸਵੀਰਾਂ ਸ਼ੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਜ਼ਰੂਰ ਸ਼ੇਅਰ ਕਰਦਾ ਹਾਂ ਜਿਸ ਵਿੱਚ ਪ੍ਰਮੁੱਖਤਾ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਆਦਿ ਹਨ ਮੈਨੂੰ ਇਹ ਤਸਵੀਰਾਂ ਸ਼ੇਅਰ ਕਰਦਿਆਂ ਬਹੁਤ ਹੀ ਖੁਸ਼ੀ ਹੁੰਦੀ ਹੈ ਮੈਂ ਕਈ ਜਗ੍ਹਾ 'ਤੇ ਘੁੰਮਣ ਜਾਂਦਾ ਹਾਂ ਮੈਂ ਉੱਥੋਂ ਦੀ ਲੋਕੇਸ਼ਨ 'ਤੇ ਆਪਣੀਆਂ ਤਸਵੀਰਾਂ ਪਾ ਕੇ ਲੋਕਾਂ ਨੂੰ ਵੀ ਦੱਸਦਾ ਹਾਂ ਕਿ ਤਾਂ ਕਿ ਲੋਕੀਂ ਵੀ ਉੱਥੇ ਜ਼ਰੂਰ ਜਾਣ ਉਹ ਨਵੀਆਂ ਨਵੀਆਂ ਲੋਕੇਸ਼ਨਾਂ ਦੇ ਉੱਤੇ ਜਾਣ ਕਈ ਵਾਰੀ ਫੋਟੋਆਂ ਵਿਆਹ ਸ਼ਾਦੀਆਂ ਦੀਆਂ ਵੀ ਪਾਉਂਦਾ ਹਾਂ ਜਿੱਥੇ ਕਿ ਮੈਂ ਬਹੁਤ ਹੀ ਆਨੰਦਮਈ ਹੋਇਆ ਹੁੰਦਾ ਹਾਂ ਨੱਚਣ ਗਾਉਣ ਦੀਆਂ ਫੋਟੋਆਂ ਅਤੇ ਤਸਵੀਰਾਂ ਜਾਂ ਵੀਡੀਓ ਮੈਂ ਅਪਲੋਡ ਕਰਦਾ ਰਹਿੰਦਾ ਹਾਂ ਇਸ ਨਾਲ ਮੈਨੂੰ ਬੜਾ ਹੀ ਦਿਲ ਪਰਚਾਵਾ ਹੁੰਦਾ ਹੈ ਮੈਂ ਆਪਣੇ ਆਪ ਨੂੰ ਬੜਾ ਹੀ ਖੁਸ਼ ਮਹਿਸੂਸ ਕਰਦਾ ਹਾਂ ਤਾਂ ਕਿ ਜਿੰਨੇ ਵੀ ਲਾਇਕਸ ਵਗੈਰਾ ਮੈਨੂੰ ਜਾਂ ਕਮੈਂਟਸ ਵਗੈਰਾ ਮੈਨੂੰ ਆਉਂਦੇ ਹਨ ਮੈਂ ਉਹਨਾਂ ਦਾ ਭਰਪੂਰ ਧੰਨਵਾਦ ਕਰਦਾ ਹਾਂ ਮੈਨੂੰ ਇਸ ਤਰ੍ਹਾਂ ਆਪਣਾ ਜੋ ਕਿ ਮਨੋਰੰਜਨ ਕਰਦਾ ਹਾਂ ਮੈਨੂੰ ਬੜਾ ਹੀ ਵਧੀਆ ਮਹਿਸੂਸ ਹੁੰਦਾ ਹੈ